ਅੱਜ ਦੇ ਯੁਗ ਵਿਚ ਬਹੁਤ ਸਾਰੇ ਤਕਨੀਕੀ ਗੈਜਟ ਆ ਚੁੱਕੇ ਜਿਵੇਂ ਕੀ ਲੈਪਟਾਪ ਮੋਬਾਈਲ ਕੰਪਿਊਟਰ ਤੇ ਸਮਾਰਟ ਵਾਚਸ ਪਰ ਮੈਨੂੰ ਇਹਨਾਂ ਵਿੱਚੋਂ ਜਿਆਦਾ ਵਧੀਆ ਮੋਬਾਈਲ ਫ਼ੋਨ

ਮੋਬਾਇਲ ਫੋਨ ਦੀ ਵਰਤੋਂ ਨਾਲ ਅਸੀਂ ਕਿਸੇ ਨਾਲ ਵੀ ਕਿਤੇ ਮਰਜ਼ੀ ਜਾ ਕੇ ਗੱਲਬਾਤ ਕਰ ਸਕਦੇ ਸਕਦੇ ਇਸ ਲਈ ਇਸ ਲਈ ਸਾਨੂੰ ਕਿਸੇ ਵੀ ਵਾਇਰ ਵਗੈਰਾ ਦੀ ਲੋੜ ਨਹੀਂ ਪੈਂਦੀ ਵੀਵੋ ਮੋਬਾਈਲ ਫੋਨ ਦੇ ਨਾਲ ਜੋ ਵੀ ਅਨੁਭਵ ਹੋਇਆ ਬਹੁਤ ਹੀ ਵਧੀਆ ਹੋਇਆ ਮੈਂ ਇਸ ਤੇ ਵੱਖ ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਦੀ ਵੀ ਵਰਤੋਂ ਕੀਤੀ ਹੈ ਜਿਵੇਂ ਕਿ ਫੇਸਬੂਕ ਵ੍ਹਾਟਸ ਐਪ ਇੰਸਟਾਗਰਾਮ ਟਵੀਟਰ ਟੈਲੀਗਰਾਮ ਜਿਸ ਨਾਲ ਮੇਰਾ ਅਨੁਭਵ ਬਹੁਤ ਚੰਗਾ ਰਿਹਾ ਮੈਂ ਹਮੇਸ਼ਾ ਹੀ ਮੋਬਾਈਲ ਫੋਨ ਨੂੰ ਵਰਤਦਾ ਆ ਰਿਹਾ ਇਸ ਗਜਟ ਨੂੰ ਅਜਮਾਉਣ ਦਾ ਅਤੇ ਵਰਤਨ ਦਾ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਇਸ ਉੱਤੇ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਗੇਮਸ ਮੁਵਿਸ ਸੋੰਗ੍ਸ ਦੇਖ ਸਕਦੇ ਅਤੇ ਸੁਣ ਸਕਦੇ ਜਿਸ ਨਾਲ ਅਸੀਂ ਆਪਣਾ ਮਨੋਰੰਜਨ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਮਨੋਰੰਜਨ ਦੇ ਸਾਧਨ ਦੇ ਨਾਲ ਨਾਲ ਅਸੀਂ ਇਸ ਤੋਂ ਗੱਲ ਬਾਤ ਕੱਲ ਹੋਰ ਵੀ ਤਜਰਬੇ ਲੈ ਸਕਦੇ ਹਾਂ ਜਿਵੇਂ ਕਿ ਦੁਨੀਆਂ ਦੇ ਵਿੱਚ ਅਸੀਂ ਇੰਟਰਨੈਟ ਦੀ ਵਰਤੋਂ ਕਰਕੇ ਇਸ ਦੇ ਉੱਤੇ ਕੁਝ ਵੀ ਦੇਖ ਸਕਦੇ ਹਾਂ